ਸਿੱਖਿਆ ਪ੍ਰਣਾਲੀ ਜੇ ਆਪਾਂ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਹੁਣ ਸਿੱਖਿਆ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਜਿਵੇਂ ਕਿ ਪਹਿਲਾਂ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਐਨੀਆਂ ਜ਼ਿਆਦਾ ਸਹੂਲਤਾਂ ਨਹੀਂ ਸੀ ਹੁੰਦੀਆਂ ਪੜ੍ਹਨ ਦੇ ਲਈ ਬਟ ਜੇ ਹੁਣ ਆਪਾਂ ਗੱਲ ਕਰੀਏ ਤਾਂ ਗਵਰਮੈਂਟ ਸਕੂਲਸ ਬਹੁਤ ਜ਼ਿਆਦਾ ਇੰਪਰੂਵ ਕਰ ਚੁੱਕੇ ਹਨ ਬੱਚਿਆਂ ਨੂੰ ਫਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਬੱਚਿਆਂ ਦੇ ਟਾਈਮ ਟੂ ਟਾਈਮ ਟੈਸਟ ਹੋ ਰਹੇ ਹਨ ਉਹਨਾਂ ਦੇ ਪ੍ਰੋਪਰ ਪੇਪਰ ਹੁੰਦੇ ਹਨ ਅਤੇ ਜਿਵੇਂ ਕਿ ਆਪਾਂ ਲਗਾ ਲਈਏ ਕਿ ਜਿਹੜੀ ਸਰਕਾਰ ਹੈ ਉਹ ਪ੍ਰੋਪਰ ਟਾਈਮ ਟੂ ਟਾਈਮ ਸਕੂਲਾਂ ਦੇ ਵਿੱਚ ਚੈਕਿੰਗ ਕਰਨ ਆਉਂਦੀ ਹੈ ਕਿ ਜਿਹੜੇ ਬੱਚਿਆਂ ਨੂੰ ਜਿਹੜਾ ਖਾਣਾ ਦਿੱਤਾ ਜਾ ਰਿਹਾ ਉਹ ਵਧੀਆ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜੀਆਂ ਸਕੂਲ ਦੀਆਂ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਨੇ ਗਵਰਮੈਂਟ ਵੱਲੋਂ ਸੋ ਓਵਰਆਲ ਜੇ ਆਪਾਂ ਦੇਖੀਏ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਕਾਫੀ ਜ਼ਿਆਦਾ ਇੰਮਪਰੂਵਮੈਂਟ ਹੋਈ ਹੈ ਕਿ ਹੁਣ ਜਿਹੜੇ ਪਿੰਡਾਂ ਦੇ ਬੱਚੇ ਨੇ ਉਹ ਵੀ ਐਜੂਕੇਸ਼ਨ ਲੈ ਰਹੇ ਹਨ ਪ੍ਰੋਪਰ ਐਜੂਕੇਸ਼ਨ ਲੈ ਰਹੇ ਹਨ